ਦਸਵੀਂ ਤੋਂ ਬਾਅਦ ਹਰ ਇੱਕ ਬੱਚੇ ਲਈ ਜਿਹੜਾ ਵਾ ਉਹ ਆਪਣੇ ਜੋ ਜੋ ਉਹਨਾਂ ਨੇ ਅੱਗੇ ਕਰਨਾ ਹੁੰਦਾ ਹੈ ਚਾਹੇ ਉਹ ਸਬਜੈਕਟਸ ਹੋ ਜਾਣ ਉਹ ਚੂਜ਼ ਕਰਨੇ ਕਾਫੀ ਮੁਸ਼ਕਲ ਹੋ ਜਾਂਦੇ ਆ ਪਰ ਫਿਰ ਵੀ ਉਹਨਾਂ ਅੱਗੇ ਜਿਹੜੀਆਂ ਵਾ ਚਾਰ ਤਰੀਕੇ ਦੀਆਂ ਅੋਪਸ਼ਨਸ ਰੱਖੀਆਂ ਜਾਂਦੀਆਂ ਹੈ ਜਿਸ ਤਰ੍ਹਾਂ ਇੱਕ ਮੈਡੀਕਲ ਨੋਨ ਮੈਡੀਕਲ ਕਮਰਸ ਜਾਂ ਆਰਟਸ ਅਗਰ ਜਿਨ੍ਹਾਂ ਨੇ ਤਾਂ ਕੋਈ ਡੋਕਟਰ ਵਗੈਰਾ ਵਾਲੀ ਲਾਈਨ 'ਚ ਜਾਣਾ ਹੈ ਤਾਂ ਉਹ ਮੈਡੀਕਲ ਚੂਜ਼ ਕਰਦੇ ਆ ਜਿਨ੍ਹਾਂ ਨੇ ਕੋਈ ਮੈਥ ਨਾਲ ਰਿਲੇਟਿਡ ਕਰਨਾ ਹੈ ਮੈਥ ਨੂੰ ਐਜ ਏ ਆਪਣਾ ਮੇਨ ਸਬਜੈਕਟ ਲੈ ਕੇ ਜਾਣਾ ਹੁੰਦਾ ਹੈ ਉਹ ਨੋਨ ਮੈਡੀਕਲ ਰੱਖਦੇ ਆ ਉਸ ਤੋਂ ਬਾਅਦ ਜਿਨ੍ਹਾਂ ਨੇ ਬੈਂਕ ਵਿੱਚ ਕੰਮ ਕਰਨਾ ਹੁੰਦਾ ਹੈ ਜਾਂ ਅਕਾਊਂਟਸ ਦੀ ਜਿਹੜੀ ਜੋਬ ਕਰਨੀ ਹੁੰਦੀ ਹੈ ਅਕਾਊਟੈਂਟ ਦੀ ਤਾਂ ਉਹ ਕੀ ਕਰਦੇ ਆ ਕਮਰਸ ਜਿਹੜੀ ਉਹ ਚੂਜ਼ ਕਰਦੇ ਆ ਕਿਸੇ ਨੇ ਲੋਇਅਰ ਟੀਚਰ ਜਾਂ ਫਿਰ ਜੋ ਵੀ ਆਪਣਾ ਜੱਜ ਵਗੈਰਾ ਬਣਨਾ ਹੁੰਦਾ ਹੈ ਉਹ ਕੀ ਕਰਦਾ ਹੈ ਆਰਟਸ ਚੂਜ਼ ਕਰਦਾ ਹੈ ਇਸ ਤਰੀਕੇ ਨਾਲ ਸਾਰਿਆਂ ਕੋਲ ਜਿਹੜੀਆਂ ਵਾ ਵੱਖੋ ਵੱਖਰੀਆਂ ਅੋਪਸ਼ਨਸ ਹੁੰਦੀਆਂ ਹੈ ਪਰ ਇਹ ਬੱਚੇ ਜਿਹੜੇ ਆ ਉਹ ਆਪਣੇ ਇੰਟਰਸਟ ਆਪਣੇ ਜੋ ਰੁਚੀ ਦੇ ਅਕੋਰਡਿੰਗ ਜਿਹੜਾ ਉਹਨਾਂ ਨੂੰ ਚੂਜ਼ ਕਰਦੇ ਆ ਕਿ ਕਿਸ ਬੱਚੇ ਨੂੰ ਕਿਹਦੇ ਵੱਲ ਇੰਟਰਸਟ ਵਾ ਅਤੇ ਉਹ ਕਿਸ ਤਰ੍ਹਾਂ ਉਹਨੂੰ ਅੱਗੇ ਲੈ ਕੇ ਜਾ ਸਕਦਾ ਹੈ ਅਗਰ ਤਾਂ ਜਿਹਨੂੰ ਹਮੇਸ਼ਾ ਉਹੀ ਲਾਈਨ ਚੂਜ਼ ਕਰਨੀ ਚਾਹੀਦੀ ਆ ਜਿਹਦੇ ਵਿੱਚ ਉਸਦਾ ਇੰਟਰਸਟ ਹੋਵੇ ਰੁਚੀ ਹੋਵੇ ਇਸ ਤਰ੍ਹਾਂ ਕੀ ਹੋਊਗਾ ਕਿ ਉਹਨਾਂ ਦਾ ਅੱਗੇ ਜੋ ਵੀ ਕਦੀ ਵੀ ਪ੍ਰੋਬਲਮ ਨਹੀਂ ਆਊਗੀ ਅਤੇ ਉਹ ਕਦੇ ਵੀ ਇਸ ਚੀਜ਼ ਵਿੱਚ ਬੋਰ ਨਹੀਂ ਹੋਣਗੇ ਸੋ ਇਸ ਕਰਕੇ ਬੱਚਿਆਂ ਕੋਲ ਕਾਫੀ ਜ਼ਿਆਦਾ ਵਿੱਦਿਅਕ ਤਰਜੀਹਾਂ ਹੈਗੀਆਂ ਹੈ ਅਤੇ ਇਹ ਵੀ ਤਾਂ ਹੈਗੀਆਂ ਹੈ ਤਾਂ ਕਿ ਉਹ ਜਿਹੜੇ ਆ ਆਪਣੇ ਅਕੋਰਡਿੰਗ ਵੱਖੋ ਵੱਖਰੀਆਂ ਜਿਹੜੀਆਂ ਲਾਈਨਸ ਆ ਅੋਪਸ਼ਨਸ ਜਿਹੜੀਆਂ ਉਹ ਚੂਜ਼ ਕਰ ਸਕਣ